ਐਲ ਪੀ ਜੀ ਗੈਸ ਸਿਲੰਡਰ ਦੀ ਘਰ ਵਿੱਚ ਵਰਤੋਂ ਖਾਣਾ ਬਣਾਉਣ ਲਈ ਘਰ ਵਿੱਚ ਵਰਤੋਂ ਕਰਦਿਆਂ ਸਮੇਂ ਉਸਨੂੰ ਕਦੀ ਵੀ ਰੋੜ ਕੇ ਨਹੀਂ ਲਿਜਾਣਾ ਚਾਹੀਦਾ ਉਸਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈਜਾਣ ਲਈ ਬੜੇ ਆਰਾਮ ਨਾਲ ਚੁੱਕ ਕੇ ਲਿਜਾਣਾ ਚਾਹੀਦਾ ਹੈ ਅਤੇ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਉਸਦਾ ਗੈਸ ਸਿਲੰਡਰ ਜੋ ਹੈ ਉਸ ਵਿੱਚੋਂ ਗੈਸ ਲੀਕ ਤਾਂ ਨਹੀਂ ਕਰ ਰਹੀ ਔਰ ਉਸ ਦੇ ਵਿੱਚ ਪਾਈਪ ਜਿਹੜਾ ਹੈ ਉਹ ਵਧੀਆ ਢੰਗ ਨਾਲ ਲੱਗਾ ਹੋਣਾ ਚਾਹੀਦਾ ਹੈ ਜੋ ਕਿ ਗੈਸ ਚੁੱਲੇ ਤੱਕ ਆਉਂਦਾ ਹੈ ਉਸ ਤੋਂ ਬਾਅਦ ਜੋ ਵੀ ਗੈਸ ਦੇਖੋ ਗੈਸ ਕੋਈ ਵੀ ਘਰ ਦੇ ਵਿੱਚ ਤੁਸੀਂ ਅੱਗ ਅੱਗ ਲੱਗਣ ਵਾਲੀ ਚੀਜ਼ ਉਹਦੇ ਲਾਗੇ ਨਾ ਰੱਖੋ ਜਿਹਦੇ ਨਾਲ ਕਿ ਉਸਨੂੰ ਖ਼ਤਰਾ ਪੈਦਾ ਹੋ ਸਕੇ ਘਰ ਵਿੱਚ ਅਗਰ ਗੈਸ ਸਲੰਡਰ ਲੀਕ ਕਰ ਜਾਂਦਾ ਹੈ ਤਾਂ ਉਸ ਵੇਲੇ ਘਰ ਦੇ ਵਿੱਚ ਕੋਈ ਵੀ ਬਿਜਲੀ ਵਾਲੀ ਬਟਨ ਜਾਂ ਕੋਈ ਵੀ ਇੱਦਾਂ ਦੀ ਚੀਜ਼ ਨਾ ਚਲਾਓ ਕਿਉਂਕਿ ਉਹਦੇ ਨਾਲ ਅੱਗ ਲੱਗਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ ਫਿ ਫਿਰ ਵੀ ਕੋਸ਼ਿਸ਼ ਕਰੋ ਜੇ ਤੁਸੀਂ ਉਸ ਨੂੰ ਚੁ ਚੁੱਲੇ ਤੋਂ ਗੈਸ ਚੁੱਲੇ ਤੋਂ ਦੂਰ ਰੱਖ ਕੇ ਚਲਾਓ ਅਤੇ ਬਹੁਤ ਹੀ ਵਧੀਆ ਹੈ ਕਿਉਂਕਿ ਉਸ ਨਾਲ ਤੁਹਾਡੀ ਆਪਣੀ ਵੀ ਸੇਫਟੀ ਹੈ ਅਤੇ ਘਰ ਦੀ ਦੂਸਰਿਆਂ ਦੀ ਵੀ ਸੇਫਟੀ ਹੈ ਇਸ ਕਰਕੇ ਸਭ ਇਸ ਸਾਰੀ ਚੀਜ਼ਾਂ ਦੀ